ਭੰਗੜਾ ਇੱਕ ਮੁੱਖ ਰਾਜ ਹੈ ਜੋ ਬਹੁਤ ਹੀ ਪ੍ਰਸਿੱਧ ਹੈ ਪੰਜਾਬ ਵਿੱਚ ਭੰਗੜਾ ਕਾ ਭੰਗੜਾ ਕਰਨ ਲਈ ਖਾਸ ਪਹਿਰਾਵਾ ਵਰਤਿਆ ਜਾਂਦਾ ਹੈ ਜਿਵੇਂ ਭੰਗੜਾ ਕਰਨ ਵਾਲੇ ਗੱਭਰੂ ਚਾਦਰੇ ਨਾਲ ਕੁੜਤਾ ਪਹਿਨਦੇ ਹਨ ਅਤੇ ਫਰਲੇ ਵਾਲੀ ਪੱਗ ਪਹਿਨਦੇ ਹਨ ਉਹ ਗਲਾਂ ਵਿੱਚ ਕੈਂਠਾ ਪਾਉਂਦੇ ਹਨ ਅਤੇ ਨੋਕਾਂ ਵਾਲੀ ਜੁੱਤੀ ਪਾਉਂਦੇ ਹਨ ਇਹ ਭੰਗੜਾ ਕਰਨ ਦਾ ਅਲੱਗ ਹੀ ਪਹਿਰਾਵਾ ਹੁੰਦਾ ਹੈ ਉਹ ਆਪਣੀਆਂ ਬਾਹਾਂ 'ਤੇ ਕਲੀੜੇ ਕਲੀੜੇ ਬੰਨ੍ਹਦੇ ਹਨ ਅਤੇ ਕੰਨਾਂ ਵਿੱਚ ਨੱਤੀਆਂ ਪਾਉਂਦੇ ਹਨ ਗਲ਼ ਵਿੱਚ ਜੁਗਨੀ ਪਾਉਂਦੇ ਹਨ ਅਤੇ ਆਪਣੇ ਕੁੜਤੇ ਦੇ ਉੱਪਰ ਜੈਕਟ ਪਾਉਂਦੇ ਹਨ ਅਤੇ ਪ ਪੈਰਾਂ ਵਿੱਚ ਘੁੰਗਰੂ ਪਾਉਂਦੇ ਹਨ ਇਸ ਤਰ੍ਹਾਂ ਇਹ ਬਹੁਤ ਬਹੁਤ ਹੀ ਸ਼ਾਨਦਾਰ ਪਹਿਰਾਵਾ ਹੁੰਦਾ ਹੈ